ਮੈਂ ਇੱਕ ਲਹਿੰਗਾ ਖਰੀਦਿਆ ਸੀ ਜਿਸ ਦਾ ਡਿਜ਼ਾਈਨ ਅਤੇ ਕਲਰ ਮੈਨੂੰ ਬਹੁਤ ਪਸੰਦ ਆਇਆ ਅਤੇ ਜੋ ਪਾਉਣ ਵਿੱਚ ਵੀ ਮੈਨੂੰ ਬਹੁਤ ਆਰਾਮਦਾਇਕ ਲੱਗਿਆ